ਸਿੱਖਿਅਤ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬੀਂਗ ਐਜੂਕੇਟਿਡ ਇੱਕ ਪੜ੍ਹੇ ਲਿਖੀ ਜਿੱਦਾਂ ਮੈਂ ਵਿਅਕਤੀ ਹੋਣ ਦੇ ਨਾਤੇ ਬਹੁਤ ਜ਼ਿਆਦਾ ਹੀ ਦਾਅਵੇ ਨਾਲ ਇਹ ਗੱਲ ਕਰ ਸਕਦੀ ਆ ਵੀ ਜਿਹੜਾ ਸਿੱਖਿਅਤ ਹੋਣਾ ਉਹ ਇਨ੍ਹਾਂ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਵਿੱਚ ਇੰਨੀ ਮਦਦ ਕਰਦਾ ਹੈ ਵੀ ਮਤਲਬ ਤੁਸੀਂ ਕਿੱਥੇ ਵੀ ਹੋ ਕਿੱਥੇ ਵੀ ਹੋ ਨਾ ਤੁਸੀਂ ਉਹ ਮਤਲਬ ਤੁਸੀਂ ਫੇਲ੍ਹ ਨਹੀਂ ਹੋ ਸਕਦੇ ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਬੰਦਾ ਐਜੂਕੇਟਿਡ ਹੈ ਪੜ੍ਹਿਆ ਲਿਖਿਆ ਹੈਗਾ ਉਹ ਜ਼ਿੰਦਗੀ ਦੇ ਕਿਸੇ ਮੁਕਾਮ ਵਿੱਚ ਵੀ ਫੇਲ੍ਹ ਨਹੀਂ ਹੁੰਦਾ ਪਰ ਪੜ੍ਹੇ ਲਿਖੇ ਹੋਣ ਨਾਲੋਂ ਜ਼ਿਆਦਾ ਮਹੱਤਵ ਰੱਖਦਾ ਹੈ ਤੁਹਾਨੂੰ ਪੜ੍ਹਾਈ ਦੀ ਮਹੱਤਤਾ ਦਾ ਪਤਾ ਹੋਣਾ ਵੀ ਤੁਸੀਂ ਤੁਹਾਨੂੰ ਬੋਲਣ ਦੀ ਅਕਲ ਹੋਵੇ ਰਿਸਪੈਕਟ ਹੋਣੀ ਚਾਹੀਦੀ ਹੈ ਤੁਹਾਡੇ ਮਨ ਵਿੱਚ ਹਰ ਕਿਸੇ ਲਈ ਅਤੇ ਅੱਜ ਕੱਲ੍ਹ ਇੰਨਾ ਜ਼ਿਆਦਾ ਪੜ੍ਹਾਈ ਦਾ ਜਿਹੜਾ ਕੋਂਪਟੀਸ਼ਨ ਆ ਉਹ ਵੱਧ ਚੁੱਕਿਆ ਇੰਨਾ ਜ਼ਿਆਦਾ ਵੱਧ ਚੁੱਕਿਆ ਵੀ ਮਤਲਬ ਹਰ ਇੱਕ ਹਰ ਇੱਕ ਪੋਸਟ 'ਤੇ ਲੱਗਣ ਲਈ ਸਰਕਾਰੀ ਨੌਕਰੀ ਦੀ ਪੋਸਟ ' ਲੱਗਣ ਲਈ ਹਰ ਇੱਕ ਖਿੱਤੇ ਦੇ ਵਿੱਚ ਜਿਹੜੀ ਪੜ੍ਹਾਈ ਬਹੁਤ ਮਹੱਤਵ ਰੱਖਦੀ ਹੈ ਅਣਪੜ੍ਹ ਲੋਕਾਂ ਦੀ ਮਤਲਬ ਪਹਿਲਾ ਹੁੰਦਾ ਸੀ ਕੋਈ ਜਮਾਨਾ ਜਦੋਂ ਹੁੰਦਾ ਸੀ ਵੀ ਹਾਂ ਕੋਈ ਨਹੀਂ ਬਿਨਾਂ ਪੜ੍ਹਿਆ ਲਿਖਿਆ ਵੀ ਬੰਦਾ ਚੱਲ ਜਾਏਗਾ ਪਰ ਨਹੀਂ ਮੈਨੂੰ ਨਹੀਂ ਲੱਗਦਾ ਵੀ ਅੱਜ ਹੈਗਾ ਵੀ ਜੇ ਮਾਂ ਬਾਪ ਸੋਚਣ ਕਿ ਅਸੀਂ ਆਪਣੇ ਬੱਚੇ ਨੂੰ ਦਸਵੀਂ ਕਰਾ ਲਾਂਗੇ ਸੱਤਵੀਂ ਅੱਠਵੀਂ ਕਰਾ ਲਾਂਗੇ ਬਹੁਤ ਹੈ ਬਿਲਕੁਲ ਵੀ ਨਹੀਂ ਅੱਜ ਕੱਲ੍ਹ ਤਾਂ ਪੜ੍ਹਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਇੰਨੀ ਜ਼ਿਆਦਾ ਵੀ ਮਤਲਬ ਕੋਈ ਅੰਤ ਨਹੀਂ ਹੈ ਅੱਜ ਕੱਲ੍ਹ ਬਜ਼ੁਰਗ ਲੋਕ ਪੜ੍ਹਾਈ ਲਈ ਕਿੰਨਾ ਕੁਛ ਕਰਦੇ ਹੈ ਮੇਰੇ ਉਹਨਾਂ ਕੋਲ ਮੇਰੇ ਸਿਸਟਰ ਟੀਚਿੰਗ ਕਰਦੇ ਉਹਨਾਂ ਕੋਲ ਫੋਰਨਰ ਪਚਵੰਜਾ ਸਾਲ ਦਾ ਓਲਡ ਪਰਸਨ ਨੇ ਇੰਗਲਿਸ਼ ਕਲਾਸਿਸ ਮਤਲਬ ਆਪਣੇ ਜੁਆਇਨ ਕਰਨ ਵਾਸਤੇ ਪੜ੍ਹਾਈ ਹੈ ਉਹ ਵੀ ਕਾਲ ਕੀਤੀ ਕਲਾਸਿਸ ਲਿੱਤੀਆਂ ਇੱਕ ਤੇਈ ਚੌਵੀ ਸਾਲ ਦੀ ਪੱਚੀ ਸਾਲ ਦੀ ਕੁੜੀ ਤੋਂ ਇੱਕ ਪਚਵੰਜਾ ਸਾਲ ਦੇ ਅੰਕਲ ਨੇ ਕਲਾਸਿਸ ਕਾਹਦੀਆਂ ਪੜ੍ਹਾਈ ਦੀਆਂ ਮਤਲਬ ਹੈਰਾਨੀ ਦੀ ਗੱਲ ਹੈ ਵੀ ਮਤਲਬ ਇ ਇਸ ਤੋਂ ਆਪਾਂ ਅਨੁਮਾਨ ਲਗਾ ਸਕਦੇ ਹਾਂ ਵੀ ਹਰ ਖਿੱਤੇ ਵਿੱਚ ਹਰ ਤਰ੍ਹਾਂ ਦੇ ਉਹਦੇ ਵਿੱਚ ਵੀ ਪੜ੍ਹਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਜੇ ਮੈਂ ਅਣਪੜ੍ਹ ਲੋਕਾਂ ਦੀ ਗੱਲ ਕਰਾਂ ਜਿਹੜੇ ਮਤਲਬ ਹਾਂ ਮਨ ਵਿੱਚ ਇੱਜਤ ਬਹੁਤ ਹੈ ਠੀਕ ਆ ਉਹਨਾਂ ਨੂੰ ਅਕਲ ਹੁੰਦੀ ਰਿਸਪੈਕਟ ਹੁੰਦਾ ਬਟ ਅਣਪੜ੍ਹ ਮੀਨਸ ਵੀ ਜਿਸ ਨੂੰ ਗਿਆਨ ਨਹੀਂ ਹੈ ਮਤਲਬ ਪਤਾ ਨਹੀਂ ਹੈ ਵੀ ਜਿਹੜਾ ਪਾਣੀ ਵਿੱਚ ਤੇਲ ਕਿਉਂ ਨਹੀਂ ਮਿਕਸ ਹੁੰਦਾ ਉਹਨੂੰ ਨਹੀਂ ਪਤਾ ਨਹੀਂ ਹੁੰਦਾ ਨਹੀਂ ਹੁੰਦਾ ਉਹਦੇ ਵਾਸਤੇ ਬਟ ਇੱਕ ਲੋਜਿਕ ਹੈ ਵੀ ਏਅਰ ਆਇਲ ਡਜ ਨੋਟ ਵੋਟ ਡਜ ਨੋਟ ਡੀਸੋਲਵ ਇਨ ਵੋਟਰ ਇਹ ਲੋਜਿਕ ਹੈ ਬਟ ਉਸ ਬੰਦੇ ਨੂੰ ਨਹੀਂ ਪਤਾ ਉਸ ਲਈ ਤਾਂ ਨਹੀਂ ਹੁੰਦਾ ਨਾ ਹੋਵੇ ਹੁਣ ਉਸਨੂੰ ਇਹ ਨਹੀਂ ਪਤਾ ਵੀ ਮੋਮਬੱਤੀ ਜਲ ਰਹੀ ਹੈ ਤਾਂ ਉਹ ਹਵਾ ਨਾਲ ਜਗ ਰਹੀ ਉਹਦੇ ਭਾਣੇ ਤਾਂ ਹਵਾ ਚੱਲੇਗੀ ਤਾਂ ਮੋਮਬੱਤੀ ਬੁੱਝ ਜੇਗੀ ਪਰ ਜਦੋਂ ਆਪਾਂ ਗਲਾਸ ਕੱਚ ਦਾ ਗਲਾਸ ਆਪਾਂ ਰੱਖ ਦੇਈਏ ਮੋਮਬੱਤੀ ਦੇ ਉੱਤੇ ਮੋਮਬੱਤੀ ਉਦੋਂ ਬੁੱਝ ਜੇਗੀ ਜਦੋਂ ਉਹਨੂੰ ਆਕਸੀਜਨ ਨਹੀਂ ਮਿਲੇਗੀ ਉਹ ਆਕਸੀਜਨ ਨਾਲ ਚੱਲ ਰਹੀ ਹੈ ਹੁਣ ਅਨਪੜ੍ਹ ਵਿਅਕਤੀ ਇਹ ਸਭ ਗੱਲਾਂ ਤੋਂ ਖੁੱਜਦਾ ਹੁਣ ਕੋਈ ਆਪਾਂ ਐਗਜੀਬਿਸ਼ਨ ਲੱਗਦੀ ਹੈ ਪੜ੍ਹੇ ਲਿਖੇ ਵਿਅਕਤੀ ਨੂੰ ਪਤਾ ਵੀ ਹਾਂ ਵੀ ਇਹ ਇਹ ਜਿਹੜਾ ਜੋ ਵੀ ਲੱਗਿਆ ਹੋਇਆ ਐਗਜੀਬਿਸ਼ਨ ਦੇ ਵਿੱਚ ਇਹ ਸਮਾਨ ਲੱਗਿਆ ਹੋਇਆ ਕੋਈ ਉਹ ਸਮਾਨ ਲੱਗਿਆ ਹੋਇਆ ਉਹ ਸਮਾਨ ਮਤਲਬ ਕਿਸ ਕੰਮ ਲਈ ਹੈ ਕਿਸ ਕੰਮ ਲਈ ਵਰਤਿਆ ਜਾਣਾ ਕੋਈ ਵੀ ਮਤਲਬ ਹੁਣ ਆਪਾਂ ਕੱਲ੍ਹ ਨੂੰ ਕੋਈ ਕੰਮ ਖੋਲ੍ਹਦੇ ਹਾਂ ਪੜ੍ਹਾਈ ਕਿੰਨੀ ਜ਼ਿਆਦਾ ਜ਼ਰੂਰੀ ਹੈ ਪੜ੍ਹਾਈ ਜ਼ਰੂਰੀ ਇਸ ਤਰ੍ਹਾਂ ਵੀ ਕੱਲ੍ਹ ਨੂੰ ਆਪਾਂ ਕੋਈ ਕੰਮ ਖੋਲ੍ਹਿਆ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਵੀ ਆਪਾਂ ਗੁਣਾ ਕਰਕੇ ਜੇ ਆਪਾਂ ਇੱਕ ਚੀਜ਼ ਆਪਾਂ ਪੱਚੀ ਰੁਪਏ ਦੀ ਲਿੱਤੀ ਹੈ ਅਤੇ ਆਪਾਂ ਜੇ ਉਹਨੂੰ ਚਾਰ ਨਾਲ ਗੁਣਾ ਕਰਾਂਗੇ ਤਾਂ ਸੌ ਹੋਏਗਾ ਤਾਂ ਤੁਸੀਂ ਕੀ ਕੀ ਕੰਮ ਹੀ ਕੀ ਕਰ ਸਕਦੇ ਹੋ ਕੋਈ ਕੰਮ ਨਹੀਂ ਕਰ ਸਕਦੇ ਤੁਹਾਡੇ ਲਈ ਹਰ ਇੱਕ ਚੀਜ਼ ਲਈ ਹੁਣ ਇਹ ਨੋਰਮਲ ਕੰਮ ਵੀ ਜੇ ਕਰਨਾ ਚਲੋ ਤੁਸੀਂ ਜੇ ਘਰ ਵੀ ਚਲਾਉਣਾ ਤੁਹਾਨੂੰ ਘਰ ਵਿੱਚ ਕੋਈ ਹੋਰ ਬੰਦਾ ਨੌਕਰੀ ਕਰ ਰਿਹਾ ਹਰ ਮਹੀਨੇ ਉਹ ਤੁਹਾਨੂੰ ਪੈਸੇ ਦੇ ਰਿਹਾ ਵੀ ਤੁਸੀਂ ਜਿਹੜਾ ਹੈਗਾ ਘਰ ਚਲਾਉਣਾ ਹੈਗਾ ਹੁਣ ਜੇ ਤੁਸੀਂ ਪੜ੍ਹੇ ਲਿਖੇ ਹੀ ਨਹੀਂ ਹੋ ਪੜ੍ਹੇ ਲਿਖੇ ਤੋਂ ਭਾਵ ਤੁਹਾਨੂੰ ਗਿਆਨ ਹੀ ਨਹੀਂ ਹੈ ਵੀ ਕਿਸ ਤਰ੍ਹਾਂ ਮੈਂ ਆਪਣਾ ਜਿਹੜੀ ਹੈਗੀ ਹੈ ਮੈਨੇਜਮੈਂਟ ਮੈਂ ਕਿੱਦਾਂ ਕਰਨੀ ਆ ਉਹ ਕਿੱਦਾਂ ਕੰਮ ਕਰਨਾ ਹੈ ਨਾ ਤਾਂ ਤਾਂ ਤੁਹਾਨੂੰ ਮਤਲਬ ਕਿ ਇੱਕ ਮਨੁੱਖ ਕੀ ਹੀ ਉਹ ਕਰ ਸਕਦਾ ਵੀ ਮੈਂ ਕਿਵੇਂ ਕਰਾਂਗਾ ਅਗਲਾ ਸਾਰੇ ਪੈਸੇ ਪਹਿਲੇ ਦਸ ਪੰਦਰਾਂ ਦਿਨ 'ਚ ਹੀ ਖਰਚ ਦੇ ਅਗਲੇ ਪੰਦਰਾਂ ਦਿਨ ਵਿਹਲਾ ਬੈਠਾ ਰਹੇ ਫਰੀ ਬੈਠਾ ਰਹੇ ਅਗਲੇ ਕਿਉੰਕਿ ਹਿਸਾਬ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਕਿੱਥੇ ਖਰਚਣੇ ਕਿੱਥੇ ਨਹੀਂ ਖਰਚਣੇ ਪੈਸੇ ਜਿਹੜੀ ਮਤਲਬ ਸਿੱਖਿਅਤ ਹੋਣਾ ਮੈਂ ਕਹਾਂਗੀ ਵੀ ਇੱਕੀਵੀਂ ਸਦੀ ਦੇ ਵਿੱਚ ਇੰਨਾ ਜ਼ਿਆਦਾ ਜ਼ਰੂਰੀ ਹੈ ਇੰਨਾ ਜ਼ਿਆਦਾ ਵੀ ਮਤਲਬ ਮਤਲਬ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਤੁਸੀਂ ਪੜ੍ਹਾਈ ਨਾ ਲੈ ਕੇ ਤੁਸੀਂ ਕੀ ਚੀਜ਼ ਨੂੰ ਗਵਾ ਰਹੇ ਹੋ ਤੁਸੀਂ ਕਿਸੇ ਲਾਇਕ ਨਹੀਂ ਹੋ ਅਨਪੜ੍ਹ ਵਿਅਕਤੀ ਸਿਰਫ਼ ਦਿਹਾੜੀ ਹੀ ਕਰ ਸਕਦਾ ਠੀਕ ਹੈ ਅਤੇ ਉਹ ਪੜ੍ਹੇ ਲਿਖੇ ਦਾ ਮੁਕਾਬਲਾ ਨਹੀਂ ਕਰ ਸਕਦਾ ਅਨਪੜ੍ਹ ਵਿਅਕਤੀ ਜਿਹੜਾ ਹੁੰਦਾ ਉਹ ਚਾਰ ਤੁਸੀਂ ਹੈ ਮਤਲਬ ਆਪਾਂ ਇਸ ਤਰ੍ਹਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਜਿਹੜਾ ਅਨਪੜ੍ਹ ਵਿਅਕਤੀ ਹੈ ਉਹ ਅਗਰ ਚਾਰ ਦਿਨ ਕੰਮ ਕਰ ਰਿਹਾ ਅਤੇ ਉਹਨੂੰ ਉੱਨੇ ਪੈਸੇ ਮਿਲ ਰਹੇ ਲਾ ਲਉ ਚਾਰ ਦਿਨ ਕੰਮ ਕਰਕੇ ਚਾਰ ਹਜ਼ਾਰ ਰੁਪਇਆ ਕਮਾ ਰਿਹਾ ਤਾਂ ਜਿਹੜਾ ਪੜ੍ਹਿਆ ਲਿਖਿਆ ਵਿਅਕਤੀ ਹੈ ਨਾ ਅਗਰ ਉਹ ਮਾਇੰਡ ਨਾਲ ਦਿਮਾਗ ਨਾਲ ਕੰਮ ਕਰੇ ਤਾਂ ਉਹ ਡੇਢ ਤੋਂ ਦੋ ਦਿਨ ਦੇ ਵਿੱਚ ਉਹੀ ਚਾਰ ਹਜ਼ਾਰ ਕਮਾ ਸਕਦਾ ਇਹ ਹੈ ਪੜ੍ਹਾਈ ਦੀ ਮਹੱਤਤਾ ਇਸ ਨੂੰ ਮੰਨਦੀ ਐ ਮੈਂ ਪੜ੍ਹਾਈ ਦੀ ਮਹੱਤਤਾ ਤਾਂ ਇਸ ਲਈ ਮੇਰਾ ਇਹੀ ਅਸਜੈਸ਼ਨ ਇਹ ਹੈ ਵੀ ਮੈਂ ਆਪ ਟੀਚਰ ਹੋ ਕੇ ਇਹੀ ਮੰਨਦੀ ਹਾਂ ਵੀ ਪੜ੍ਹਾਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ ਅਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਵਿਅਕਤੀ ਨੂੰ ਸਿੱਖਿਆ ਜਿਹੜੀ ਹੈ ਉਹ ਆਪਣੇ ਬਚਪਨ ਤੋਂ ਹੀ ਆਪਣਾ ਬੇਸ ਹੀ ਇੰਨਾ ਸਟਰੋਂਗ ਕਰਨਾ ਚਾਹੀਦਾ ਵੀ ਆਉਣ ਵਾਲੇ ਸਮੇਂ ਵਿੱਚ ਹਰ ਚੁਣੌਤੀ ਨੂੰ ਉਹ ਫੇਸ ਕਰ ਸਕੇ ਹਰ ਚੁਣੌਤੀ ਨੂੰ ਆਪਣੇ ਨਾਲ ਲੈ ਸਕੇ ਅਤੇ ਅੱਗੇ ਚੱਲ ਸਕੇ ਧੰਨਵਾਦ ਜੀ